ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਔਰਬਿਟ ਬੱਸ ਸਰਵਿਸ ਬੋਲ ਰਹੇ ਹੋ ਜੀ ਹਾਂਜੀ ਸਰ ਮੈਂ ਅਬਹੋਰ ਤੋਂ ਬੋਲ ਰਿਹਾ ਸੀ ਅਤੇ ਮੈਂ ਬਠਿੰਡੇ ਗਰਮੀਆਂ 'ਚ ਅਸੀਂ ਬੱਚਿਆਂ ਨੂੰ ਲੈ ਕੇ ਘੁੰਮਣ ਆਏ ਹੋਏ ਸੀ ਜੀ ਅਤੇ ਅੱਗੇ ਅਸੀਂ ਸੋਚ ਰਿਹਾ ਸੀ ਬਠਿੰਡਾ ਤਾਂ ਘੁੰਮ ਲਿਆ ਅਤੇ ਅਸੀਂ ਅੱਗੇ ਅੰਮ੍ਰਿਤਸਰ ਜਾਣਾ ਸੀਗਾ ਅਤੇ ਅਸੀਂ ਬੱਸ ਸਰਵਿਸ ਬਾਰੇ ਪੁੱਛ ਰਹੇ ਸੀਗੇ ਵੀ ਆਪਣੇ ਔਰਬਿਟ ਵਾਲਿਆਂ ਦੀਆਂ ਬੱਸਾਂ ਵਗੈਰਾ ਟੂਰ ਵਗੈਰਾ ਜਾਂਦੇ ਹੋਣ ਤਾਂ ਪਰ ਏ ਸੀ ਦਾ ਆਪਣੇ ਕਿੰਨਾ ਰੇਟ ਵਗੈਰਾ ਇਹਨਾਂ ਦਾ ਹੈਗਾ ਟਿਕਟਸ ਵਗੈਰਾ ਦਾ ਸਰ ਅਸੀਂ ਦੋ ਜਣੇ ਆ ਮੇਰੀ ਵਾਈਫ ਹੈ ਅਤੇ ਦੋ ਬੇਟੇ ਹੈ ਜੀ ਚਾਰ ਜਣੇ ਅੱਛਾ ਜੀ ਅਤੇ ਆਉਣ ਜਾਣ ਦੀ ਸੁਵਿਧਾ ਹੈਗੀ ਹੈ ਜੀ ਆਉਣ ਲਈ ਵੀ ਅੱਛਾ ਦੋਨਾਂ ਦਾ ਅੱਛਾ ਦੋਨਾਂ ਦਾ ਮਤਲਬ ਕਿੰਨਾ ਕਿਰਾਇਆ ਸਰ ਅੱਛਾ ਜੀ ਠੀਕ ਹੈ ਜੀ ਅਤੇ ਦੂਸਰੀ ਇਸ ਤੋਂ ਏ ਸੀ ਤੋਂ ਇਲਾਵਾ ਦੂਸਰੀ ਬੱਸ ਦਾ ਜੀ ਅੱਛਾ ਅੱਛਾ ਜੀ ਠੀਕ ਹੈ ਸਰ ਅੱਛਾ ਟਾਈਮਿੰਗ ਵਗੈਰਾ ਜ਼ਿਆਦਾ ਤਾਂ ਨਹੀਂ ਲਾਉਂਦੇ ਸਰ ਰਸਤੇ 'ਚ ਤਾਂ ਨਹੀਂ ਰੁਕਦੇ ਰੁਕਦੇ ਕਿਤੇ ਠੀਕਹੈ ਸਰ ਅਤੇ ਸਰ ਇਹ ਦਾ ਬੁਕਿੰਗ ਵਗੈਰਾ ਦਾ ਕਿਵੇਂ ਫਿਰ ਕਿਵੇਂ ਪ੍ਰੋਸੈਸ ਵਗੈਰਾ ਕਿਵੇਂ ਕਰਨਾ ਪਏਗਾ ਹਾਂਜੀ ਹਾਂਜੀ ਠੀਕ ਹੈ ਜੀ ਅਸੀਂ ਹੁਣ ਬਠਿੰਡੇ ਹੀ ਆ ਇੱਕ ਵਾਰ ਅਸੀਂ ਜਾ ਰਹੇ ਹੈ ਜੀ ਠੀਕ ਹੈ ਜੀ ਫਿਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਦੁਬਾਰਾ ਕਾਲ ਕਰਾਂਗੇ ਸਰ ਠੀਕ ਹੈ ਸਰ ਥੈਂਕ ਯੂ